ਅੱਜ ਕੱਲ੍ਹ ਦੇ ਬੱਚੇ ਕਈ ਸਾਰੀਆਂ ਨਵੀਆਂ ਖੇਡਾਂ ਖੇਡਦੇ ਹਨ ਨਾਲੇ ਇਹ ਖੇਡਾਂ ਬੱਚੇ ਆਪਣੇ ਫੋਨ 'ਤੇ ਖੇਡਦੇ ਹਨ ਜਾਂ ਫਿਰ ਆਪਣੇ ਮਾਪਿਆਂ ਦੇ ਫੋਨ 'ਤੇ ਖੇਡਦੇ ਹਨ ਜਿਵੇਂ ਕਿ ਪਬਜੀ ਫ੍ਰੀ ਫਾਇਰ ਆਦਿ ਇਹ ਸਾਰੀਆਂ ਖੇਡਾਂ ਬੱਚਿਆਂ ਦੀਆਂ ਸਰੀਰ ਅਤੇ ਅੱਖਾਂ 'ਤੇ ਬਹੁਤ ਪੁਸਾ ਅਸਰ ਪਾਉਂਦੀਆਂ ਹਨ ਉਹ ਉਹਨਾਂ ਦੀਆਂ ਅੱਖਾਂ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਅਤੇ ਉਹਨਾਂ ਦਾ ਸਰੀਰ ਮੋਟਾ ਹੋ ਜਾਂਦਾ ਹੈ ਸਾਰੇ ਮਾਪਿਆਂ ਨੂੰ ਇਹ ਲੋੜ ਹੈ ਕਿ ਉਹ ਆਪਣੇ ਬੱਚਿਆਂ ਨੂੰ ਕ੍ਰਿਕਟ ਫੁੱਟਬਾਲ ਹਾਕੀ ਆਦਿ ਖੇਡਾਂ ਵੱਲ ਰੁਝਾਨ ਕਰਨ